ਪੰਜਾਬ ਦਾ ਸੂਬਾ ਤਕਰੀਬਨ ਖੇਤੀ ਪ੍ਰਧਾਨ ਸੂਬਾ ਜ਼ਿਆਦਾਤਰ ਆਪਣਾ ਪੰਜਾਬ ਖੇਤੀ ਕਰਦਾ ਹੈ ਅਤੇ ਖੇਤੀ ਤਾਂ ਹੁਣ ਪਹਿਲਾਂ ਨਾਲੋਂ ਤਾਂ ਬਹੁਤ ਹੀ ਫ਼ਰਕ ਪੈ ਗਿਆ ਪਹਿਲਾਂ ਆਪਣਾ ਮਤਲਬ ਟਰੈ ਟਰੈਕਟਰ ਨਹੀਂ ਹੁੰਦੇ ਸੀਗੇ ਬੜੇ ਔਖੀ ਹੁੰਦੀ ਸੀ ਖੇਤੀ ਪਾਣੀਆਂ ਦੇ ਸਾਧਨ ਨਹੀਂ ਸੀ ਪਰ ਹੁਣ ਤਾਂ ਖੇਤੀ ਤੇ ਬੜੇ ਹੀ ਸਾਧਨ ਹੋ ਗਏ ਅਤੇ ਹੁਣ ਹਰ ਇੱਕ ਬੰਦਾ ਚਾਹੁੰਦਾ ਕਿ ਮੈਨੂੰ ਮਿਲਾਵਟ ਵਾਲੀ ਚੀਜ਼ ਨਹੀਂ ਮਿਲਣੀ ਚਾਹੀਦੀ ਮੈਨੂੰ ਔਰਗਨਿਕ ਚੀਜ਼ ਖਾਣੀ ਚਾਹੀਦੀ ਹੈ ਇਸ ਲਈ ਔਰਗਨਿਕ ਕਰਨ ਵਾਸਤੇ ਲਾਗਤ ਵੀ ਵੱਧ ਚਾਹੀਦੀ ਹੈ ਆਪਣਾ ਉਸ 'ਤੇ ਖਰਚਾ ਵੀ ਵੱਧ ਚਾਹੀਦਾ ਇਸ ਲਈ ਖੇਤੀ ਦਾ ਹੁਣ ਔ ਔਰਗਨਿਕ ਵਾਲੇ ਪਾਸੇ ਨੂੰ ਲੋਕ ਜਾ ਰਹੇ ਨੇ ਵੱਧ ਤੋਂ ਵੱਧ ਕ੍ਰੇਜ਼ ਹੋ ਰਹੇ ਆ ਲੋਕਾਂ ਦਾ ਕਿ ਆਪਾਂ ਔਰਗਨਿਕ ਖੇਤੀ ਲਾਈਏ ਅਤੇ ਬੀਜੀਏ ਅਤੇ ਖਾਈਏ ਅਸੀਂ ਤਾਂ ਪਿੰਡਾਂ ਤੋਂ ਬਿਲੋਂਗ ਕਰਦੇ ਹਾਂ ਅਤੇ ਖੇਤੀ ਅਸੀਂ ਆਪ ਕਰਦੇ ਹਾਂ ਇੱਥੇ ਸਾਡੇ ਤਾਂ ਪਾਣੀ ਦਾ ਪੰਜਾਬ ਦੀਆਂ ਮੁੱਖ ਫ਼ਸਲਾਂ ਕਣਕ ਆਪਣਾ ਮੱਕੀ ਚੌਲ ਜੇ ਆਪਾਂ ਦੂਜੇ ਸਟੇਟਾਂ ਨੂੰ ਇਹ ਅਸੀਂ ਪ੍ਰਵਾਨ ਕਰਦੇ ਹਾਂ ਅਤੇ ਹੋਰ ਵੀ ਆ ਜਿਵੇਂ ਕੋਟਨ ਹੋ ਗਈ ਕੱਪੜਿਆਂ ਅਤੇ ਮਤਲਬ ਖੇਤੀ ਬਿਨਾਂ ਕੋਈ ਚੀਜ਼ ਚੱਲਦੀ ਨਹੀਂ ਹਰ ਚੀਜ਼ ਖੇਤੀ ਤੋਂ ਹੀ ਪੈਦਾ ਹੁੰਦੀ ਹੈ ਹੁਣ ਜਿਵੇਂ ਮੰਨ ਲਓ ਆਪਾਂ ਦੇਖ ਲਿਆ ਜਾਵੇ ਕੇਰਾਂ ਪਿੱਛੇ ਜਿਹੇ ਕਰੋਨਾ ਹੋ ਗਿਆ ਸੀ ਕਰੋਨੇ ਵੇਲੇ ਵੀ ਸਾਰੇ ਕਿੱਤੇ ਬੰਦ ਹੋ ਗਏ ਸੀ ਪਰ ਖੇਤੀ ਦਾ ਕਿੱਤਾ ਚੱਲਦਾ ਰਿਹਾ ਖੇਤੀ ਵਾਲੇ ਕਿੱਤਾ ਕਦੇ ਵੀ ਨਹੀਂ ਪਿੱਛੇ ਰਹਿ ਸਕਦਾ ਵਧੀਆ ਇਨਕਮ ਦਾ ਸਾਧਨ ਹੁਣ ਲੋਕ ਤਾਂ ਜਿਨ੍ਹਾਂ ਕੋਲ ਜਮੀਨ ਆ ਉਹ ਆਪਣਾ ਦੂਜਾ ਕੰਮ ਵੀ ਕਰਦੀ ਆ ਅਤੇ ਖੇਤੀ ਦਾ ਕੰਮ ਵੀ ਕਰਦੀ ਆ ਹੁਣ ਲੋਕਾਂ ਦਾ ਰੁਝਾਨ ਵੀ ਔਰਗਨਿਕ ਵੱਲ ਵੱਧ ਰਿਹਾ ਫਰੂਟ ਨੇ ਹੁਣ ਜਿਵੇਂ ਦੇਖ ਲਓ ਪੰਜਾਬ ਦੇ ਵਿੱਚ ਡਰੈਗਨ ਫਰੂਟ ਆ ਹੁਣ ਲੋਕਾਂ ਨੂੰ ਸਮਝ ਆ ਗਈ ਕਿ ਡਰੈਗਨ ਫਰੂਟ ਬਹੁਤ ਹੀ ਮਹਿੰਗਾ ਫਰੂਟ ਆ ਅਤੇ ਵਧੀਆ ਫਰੂਟ ਆ ਉਹਦੀ ਖੇਤੀ ਕਰਨ ਲੱਗ ਗਏ ਲੋਕ ਆਪ ਉਹ ਤੋਂ ਬਾਅਦ ਪਹਿਲਾਂ ਤਾਂ ਐ ਸੀਗਾ ਕਿ ਵੇਚ ਦਿੰਦੇ ਸੀਗੇ ਠੇਕੇ 'ਤੇ ਲੱਗ ਜਾਂਦਾ ਸੀ ਵਾਹੁਣ ਕੋਈ ਵੀ ਅਜਿਹਾ ਅਪਣਾ ਕੇ ਵੇਚ ਦਿੰਦੇ ਹਾਂ ਪਰ ਹੁਣ ਲੋਕ ਬੜੇ ਸਿਆਣੇ ਹੋ ਗਏ ਉਹਨਾਂ ਨੂੰ ਪਤਾ ਕਿ ਸਾਨੂੰ ਲਾਗਤ ਘੱਟ ਮਿਲ ਰਹੀ ਹੈ ਇਸ ਕਰਕੇ ਉਹ ਆਪਣੇ ਮੰਡੀਆਂ ਦੇ ਨੇੜੇ ਨੇੜੇ ਜਿੱਥੇ ਵੀ ਮੰਡੀਆਂ ਨੇ ਟਰੈਕਟਰ ਲੈ ਜਾਂਦੇ ਆ ਉੱਥੇ ਆਪ ਵੇਚ ਕੇ ਆਉਂਦੇ ਆ ਆਪ ਵੇਚਣ ਨਾਲ ਇਹ ਵੀ ਹੁੰਦਾ ਕਿ ਜਦੋਂ ਆਪਾਂ ਕਿਸੇ ਨੂੰ ਕੰਪਨੀ ਦਿੰਦੇ ਹਾਂ ਉਹਦੇ ਨਾਲੋਂ ਆਪ ਵੇਚਦਾ ਬੰਦਾ ਉਹੀ ਨੈਚੁਰਲ ਚੀਜ਼ ਅਗਲੇ ਦੇ ਮਿਲ ਜਾਂਦੀ ਹੈ ਚਲੋ ਅਗਲੇ ਨੇ ਵੀ ਦੋ ਪੈਸੇ ਬਣ ਜਾਂਦੇ ਵਿੱਚ ਵੀ ਨਹੀਂ ਹੁੰਦਾ ਕੋਈ ਨਾਲੇ ਸਿੱਧੇ ਹੈ ਪੈਸੇ ਮਿਲਦੇ ਆ ਇਸ ਤਰ੍ਹਾਂ ਹੀ ਲੋਕ ਫੁੱਲਾਂ ਦੀ ਖੇਤੀ ਕਰਦੇ ਆ ਮਤਲਬ ਖੇਤੀ ਵੱਲ ਬਹੁਤ ਰੁਝਾਨ ਹੋ ਰਿਹਾ ਅਤੇ ਇਹਨੂੰ ਖੇਤੀ ਨੂੰ ਇਹ ਪੰਜਾਬ ਕਿੱਤਾ ਹੈ ਅਤੇ ਇਹ ਕਿੱਤਾ ਕਦੇ ਵੀ ਨਹੀਂ ਬੰਦ ਹੋਣਾ ਚਾਹੀਦਾ ਅਸੀਂ ਤੇ ਇਸ ਵਾਰੀ ਇਹੀ ਗੱਲ ਕਰਦੇ ਹਾਂ